ਇੱਕ ਵਾਰੀ ਮੈਂ ਸਿਲਾਈ ਕਰਦੇ ਸਮੇਂ ਇੱਕ ਇਹੋ ਜਿਹਾ ਕੱਪੜਾ ਲੈ ਕੇ ਆਈ ਜੋ ਮੇਰੇ ਲਈ ਬਹੁਤ ਹੀ ਚੁਣੌਤੀਪੂਰਨ ਸੀ ਉਹ ਸੀ ਸਨਥੈਟਿਕ ਕੱਪੜਾ ਉਸ ਕੱਪੜੇ ਦੇ ਉੱਤੇ ਜਿਹੜੀਆਂ ਕੋ ਲਾਈਨਾਂ ਵਾਣੀਆਂ ਸੀ ਉਸ ਲਾਈਨਾਂ ਨੂੰ ਜਾਂ ਉਸ ਦੇ ਉੱਤੇ ਚੁੰਨਟਾਂ ਪੈਣੀਆਂ ਸੀ ਉਸ ਚੁੰਨਟਾਂ ਨੂੰ ਬਣਾਉਣ ਸਮੇਂ ਮੈਨੂੰ ਬਹੁਤ ਹੀ ਔਖਾਈ ਹੋਈ ਇਸ ਲਈ ਮੈਂ ਉਸ ਬੁਣਾਈ ਜਾਂ ਸਿਲਾਈ ਕਰਦੇ ਸਮੇਂ ਉਸ ਚੁੰਨਟਾਂ ਦੇ ਨਾਲ ਮੈਨੂੰ ਬਹੁਤ ਔਖਾ ਇਸ ਲਈ ਹੋਇਆ ਕਿ ਉਹਦੇ ਥੱਲੇ ਜਿਹੜੀ ਇੱਕ ਲਾਈਨਿੰਗ ਵੀ ਲੱਗਣੀ ਸੀ ਉਹ ਲਾਈਨਿੰਗ ਉਹਦੇ ਉੱਤੇ ਆ ਹੀ ਨਹੀਂ ਰਹੀ ਸੀ ਅਤੇ ਉਸਦੇ ਬਾਜੂ ਦੇ ਥੱਲੇ ਜਿਹੜੀ ਲਾਈਨਿੰਗ ਲੱਗਣੀ ਸੀ ਉਸ ਦੇ ਬਾਜੂ ਦੇ ਥੱਲੇ ਉਹ ਲਾਈਨਿੰਗ ਆਉਣਾ ਹੀ ਮੁਸ਼ਕਿਲ ਹੋ ਰਹੀ ਸੀ ਇਸ ਕਰਕੇ ਮੈਂ ਜਦੋਂ ਉਸ ਕੱਪੜੇ ਨੂੰ ਮੈਂ ਬਣਾਉਣ ਲੱਗੀ ਤਾਂ ਉਸ ਕੱਪੜੇ ਤੋਂ ਪਹਿਲਾਂ ਹੀ ਇਹ ਮੁਸ਼ਕਿਲ ਆਈ ਉਸ ਕੱਪੜੇ ਤੇ' ਪ੍ਰੈਸ ਕਰਨੀ ਵੀ ਔਖੀ ਹੋ ਰਹੀ ਸੀ ਉਸ ਕੱਪੜੇ ਨੂੰ ਇੰਨਾ ਜਿਹੜਾ ਉਹਦਾ ਔਖਾ ਹਿੱਸਾ ਸੀ ਜਿਸ ਸਮੇਂ ਉਹਦੀ ਬਾਜੂ ਬਣਾਉਣ ਲੱਗੀ ਸੀ ਅਤੇ ਉਸ ਉੱਤੇ ਬਾਜੂ ਬਣਾਉਂਦੇ ਸਮੇਂ ਉਹਦਾ ਕੋਲਰ ਹੀ ਨਹੀਂ ਆ ਰਿਹਾ ਸੀ ਜਿਹੜੇ ਥੱਲੇ ਕੱਫ ਲੱਗਦੇ ਹਨ ਉਹਦੇ ਥੱਲੇ ਲਾਈਨਿੰਗ ਇਸਤੇਮਾਲ ਕਰਨੀ ਸੀ ਉਹ ਲਾਈਨਿੰਗ ਉਹਦੇ ਥੱਲੇ ਬੈਠ ਹੀ ਨਹੀਂ ਰਹੀ ਸੀ ਸਭ ਤੋਂ ਚੁਣੌਤੀਪੂਰਨ ਹਿੱਸਾ ਮੈਨੂੰ ਉਹਦੇ ਬਾਹਵਾਂ ਦਾ ਲੱਗਾ ਉਸ ਦੀਆਂ ਬਾਹਵਾਂ ਬਣਾਉਣ ਦੇ ਸਮੇਂ ਕੱਫ ਦੇ ਥੱਲੇ ਲਾਈਨਿੰਗ ਆ ਫਿਰ ਉਹ ਲਾਈਨਿੰਗ ਦੇ ਉੱਤੇ ਇੱਕ ਹੋਰ ਲਾਈਨਿੰਗ ਲਗਾਉਣ ਸਮੇਂ ਉੱਤੋਂ ਕੱਪੜਾ ਵੀ ਸਨਥੈਟਿਕ ਸੀ ਜਿਹਦੇ ਨਾਲ ਸਭ ਤੋਂ ਚੁਣੌਤੀਪੂਰਨ ਮੈਨੂੰ ਉਹ ਹੀ ਇਹਦਾ ਹਿੱਸਾ ਲੱਗਾ ਉਸ ਹਿੱਸੇ ਨੂੰ ਬਣਾਉਣ ਸਮੇਂ ਮੈਨੂੰ ਇੰਨੀ ਕੁ ਜ਼ਿਆਦਾ ਮੁਸ਼ਕਿਲ ਆਈ ਜ਼ਿਤੇ ਉਸ ਕੱਪੜੇ ਨੂੰ ਉੱਤੇ ਕਿਉਂਕਿ ਸਨਥੈਟਿਕ ਕੱਪੜੇ ਦੇ ਉੱਤੇ ਛੇਤੀ ਦੇ ਨਾਲ ਫਲਾਰ ਨਹੀਂ ਬਣ ਪਾਂਦਾ ਹੈ ਇਸ ਕਰਕੇ ਉਸਨੂੰ ਬਣਾਉਣ ਸਮੇਂ ਸਭ ਤੋਂ ਚੁਣੌਤੀਪੂਰਨ ਹਿੱਸਾ ਮੈਨੂੰ ਉਹਦਾ ਹੀ ਲੱਗਿਆ ਜਿਸ ਦੇ ਨਾਲ ਮੈਨੂੰ ਉਹ ਕੱਪੜਾ ਜਿਹੜਾ ਸਨਥੈਟਿਕ ਸੀ ਉਹ ਵੀ ਚੁਣੌਤੀਪੂਰਨ ਸੀ ਅਤੇ ਮੈਂ ਉਸ ਨੂੰ ਲੈ ਕੇ ਉਸ ਉੱਤੇ ਬਣਾਇਆ ਫਿਰ ਉਸ ਨੂੰ ਉੱਤੇ ਉਸਦੇ ਉੱਤੇ ਕਢਾਈ ਕੀਤੀ ਫਿਰ ਉਸ ਉੱਤੇ ਮੈਂ ਉਹਨੂੰ ਬਣਾ ਕੇ ਫਿਰ ਉਹਦੇ ਨਾਲ ਫਰਾਕ ਦੇ ਨਾਲ ਜਿਹੜਾ ਉਹਨੂੰ ਲਗਾਉਣਾ ਸੀ ਉਹ ਵੀ ਬਹੁਤ ਹੀ ਚੁਣੌਤੀਪੂਰਨ ਸੀ ਅਤੇ ਉਹ ਸਭ ਤੋਂ ਜ਼ਿਆਦਾ ਹੀ ਮੈਨੂੰ ਉਹਦਾ ਔਖਾ ਹਿੱਸਾ ਲੱਗਾ ਸਨਥੈਟਿਕ ਕੱਪੜੇ ਦੇ ਉੱਤੇ ਲਗਾਣਾ ਹਰ ਚੀਜ਼ ਦਾ ਬਹੁਤ ਹੀ ਔਖਾ ਹਿੱਸਾ ਹੁੰਦਾ ਹੈ